ਹਾਂਜੀ ਕੌਣ ਠੀਕ ਹਾਂ ਠੀਕ ਕਿੰਨੀ ਕੁ ਉਮਰ ਦਾ ਬੱਚਾ ਜੀ ਤੁਹਾਡਾ ਅੱਛਾ ਤੁਸੀਂ ਕੀ ਖਵਾਉਂਦੇ ਹੋ ਇਸ ਟੈਮ ਬੱਚੇ ਨੂੰ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਤੁਹਾਨੂੰ ਬਿਸਕੁਟ ਕਰ ਜਮਾਂ ਨਹੀਂ ਦੇਣਾ ਚਾਹੀਦਾ ਬੱਚੇ ਨੂੰ ਕਿਉਂ ਬੱਚੇ ਦੀ ਛਾਤੀ 'ਤੇ ਬਿਸਕੁਟ ਜੰਮ ਜਾਂਦਾ ਹਾਂ ਬਿਸਕੁਟ ਤੁਸੀਂ ਉਹਨੂੰ ਬੰਦ ਕਰੋ ਸਾਦਾ ਭੋਜਨ ਦਿਓ ਬਾਕੀ ਸਰਦੀ ਦਾ ਮੌਸਮ ਹੈ ਤੁਸੀਂ ਉਹਨਾਂ ਨੂੰ ਗਰਮ ਚੀਜ਼ਾਂ ਦਿਓ ਜਿਵੇਂ ਕਿ ਭਾਫ਼ ਹੋਈ ਭਾ ਭਾਫ਼ ਦਿਓ ਬੱਚੇ ਨੂੰ ਖੰਘ ਤੋਂ ਠੀਕ ਹੈ ਬਾਕੀ ਗਰਮ ਚੀਜ਼ਾਂ ਦਿਓ ਠੰਡੀਆਂ ਨਾ ਦਿਓ ਬਾਹਰਲਾ ਖਾਣਾ ਨਾ ਦਿਓ ਹਾਂ ਰੇਸ਼ਾ ਇਸ ਕਰਕੇ ਹੀ ਹੁੰਦਾ ਹੈਗਾ ਜਦੋਂ ਆਪਾਂ ਨੇ ਬਿਸਕੁਟ ਦਿੰਦੇ ਹਾਂ ਆਪਣਾ ਸਰਦੀ ਦੇ ਵਿੱਚ ਬੱਚੇ ਦੇ ਪਤਲੇ ਕੱਪੜੇ ਪਾਉਣੇ ਮੋਟੇ ਨਹੀਂ ਪਾਉਂਦੇ ਤੁਸੀਂ ਜੁਰਾਬਾਂ ਬੂਟ ਨਹੀਂ ਪਾਉਂਦੇ ਨਾ ਇਸ ਕਰਕੇ ਫਿਰ ਬੱਚੇ ਜਦ ਬੱਚੇ ਜਦ ਤਾਰਦੇ ਹੈ ਭੈਣ ਜੀ ਫਿਰ ਆਪਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਨਾ ਬੱਚੇ ਦਾ ਹਾਂ ਫਿਰ ਇਸ ਕਰਕੇ ਤੁਸੀਂ ਮਾੜਾ ਜਿਹਾ ਆਪ ਖਿਆਲ ਰੱਖੋ ਬੱਚੇ ਦਾ ਬੱਚੇ ਨੂੰ ਤੁਸੀਂ ਗਰਮ ਕੱਪੜੇ ਪਵਾਓ ਖਾਣਾ ਵੀ ਤੁਸੀਂ ਗਰਮ ਗਰਮੀਆਂ ਵਾਲਾ ਹੀ ਦਿਓ ਗਰਮ ਠੰਡਾ ਨਾ ਦਿਓ ਤੁਸੀਂ ਬਈ ਹਾਂ ਸਿਹਤ ਬਣਨ ਵਾਸਤੇ ਜੀ ਆਪਣਾ ਉਹ ਨਾ ਬੱਚੇ ਨੂੰ ਸੈਰ ਕਰਾਓ ਬੱਚੇ ਨੂੰ ਝੂਲੇ ਉੱਪਰ ਜਿਹੜੇ ਆਪਾਂ ਕੱਦ ਵਧਾਉਣ ਵਾਸਤੇ ਉੱਪਰ ਲਮਕਣਾ ਹੁੰਦਾ ਬੱਚੇ ਨੇ ਬਾਕੀ ਵਧਣ ਫੁੱਲਣ ਵਾਸਤੇ ਤੁਸੀਂ ਮਿੱਟੀ ਦੇ ਵਿੱਚ ਖੇਡਣ ਦਿਓ ਬੱਚੇ ਨੂੰ ਥੋੜ੍ਹਾ ਜਿਹਾ ਚਿਰ ਅਤੇ ਬਾਕੀ ਤੁਸੀਂ ਪੂਰਾ ਇਹਦਾ ਬੱਚੇ ਦਾ ਧਿਆਨ ਰੱਖੋ ਤੇ ਵਧੇਗਾ ਵੀ ਫੱਲੇਗਾ ਹਾਂ ਤੁਸੀਂ ਬਾਹਰਲੀਆਂ ਬਾਹਰਲੇ ਬਾਹਰਲਾ ਖਾਣੇ ਤੋਂ ਤੁਸੀਂ ਪਰਹੇਜ਼ ਕਰੋ ਬਾਹਰ ਨਹੀਂ ਇਹ ਤਾਂ ਇਹ ਤਾਂ ਭੈਣ ਜੀ ਬਹੁਤ ਗਲਤ ਹੈ ਨਾ ਤੁਹਾਨੂੰ ਹਾਂਜੀ ਇਹ ਤਾਂ ਬਹੁਤ ਗਲਤ ਹੈ ਬੱਚੇ ਨੂੰ ਪਾਸਤਾ ਦੇਣਾ ਪੀਜ਼ਾ ਦੇਣਾ ਸਾਦਾ ਭੋਜਨ ਦਿਓ ਇਸ ਕਰਕੇ ਤੁਸੀਂ ਬੱਚੇ ਨੂੰ ਇੱਕ ਗਰਮੈਸਟੀ ਨਹੀਂ ਜੀ ਮਾਂ ਪਿਓ ਨੂੰ ਖਿਆਲ ਰੱਖਣਾ ਚਾਹੀਦਾ ਤੁਸੀਂ ਕੀ ਬੱਚੇ ਨੂੰ ਨਾ ਖਾਂਸੀ ਵਾਸ ਖਾਂਸੀ ਖਾਂਸੀ ਵਾਸਤੇ ਨਾ ਤੁਸੀਂ ਬੱਚੇ ਨੂੰ ਉਹ ਸਟੀਮ ਦਿਓ ਇੱਕ ਤਾਂ ਜ਼ਰੂਰ ਹੈ ਸਟੀਮ ਦੇਣੀ ਜਰੂਰੀ ਹੁੰਦੀ ਆ ਬੱਚੇ ਨੂੰ ਅਤੇ ਬਾਕੀ ਟੈਮ ਟੇਬਲ ਪੱਕਾ ਕਰ ਲਓ ਬਿਸਕੁਟ ਨਾ ਦਿਓ ਬੱਚੇ ਨੂੰ ਸਵੇਰ ਵੇਲੇ ਨਾਸ਼ਤਾ ਸਾਦਾ ਦਿਓ ਗਰਮ ਪਾਣੀ ਦਿਓ ਠੰਡਾ ਨਾ ਦਿਓ ਪਾਣੀ ਹਾਂਜੀ ਹਾਂ ਇਸ ਕਰ